ਤਕਨੋਲਜੀ ਸਾਡੇ ਦੁਆਰਾ ਯਾਤਰਾ ਕਰਨ ਦੀ ਸਭ ਤੋਂ ਪਹਿਲਾਂ ਯਾਤਰਾ ਕਰਨ ਵਿੱਚ ਕਿਵੇਂ ਬਦਲ ਕਰ ਰਹੀ ਹੈ ਜਿਵੇਂ ਪਹਿਲਾਂ ਕੀ ਹੁੰਦਾ ਸੀ ਕਿ ਆਪਾਂ ਕਿਸ ਕਿਤੇ ਵੀ ਜਾ ਰਹੇ ਹਾਂ ਕਿਸੇ ਵੀ ਨਵੀਂ ਜਗ੍ਹਾ 'ਤੇ ਜਾ ਰਹੇ ਹਾਂ ਤਾਂ ਤੁਹਾਨੂੰ ਪਹਿਲਾਂ ਹੀ ਰਸਤੇ ਲ ਦੇਖ ਕੇ ਜਾਣੇ ਪੈਂਦੇ ਸੀ ਜਾਂ ਆਪਣੇ ਨਾਲ ਤੁਸੀਂ ਨਕਸ਼ਾ ਲੈ ਕੇ ਜਾਂਦੇ ਸੀ ਨਹੀਂ ਤਾਂ ਤੁਹਾਨੂੰ ਜਾਂ ਫਿਰ ਤੁਹਾਨੂੰ ਰਸਤੇ ਵਿੱਚ ਰੁਕ ਰੁਕ ਕੇ ਲੋਕਾਂ ਨੂੰ ਪੁੱਛਣਾ ਪੈਂਦਾ ਸੀ ਕਿ ਹੁਣ ਕਿੱਧਰ ਨੂੰ ਜਾਣਾ ਜਾਂ ਕਿੱਧਰ ਨੂੰ ਜਾਣਾ ਪਰ ਹੁਣ ਜਿਵੇਂ ਕਿ ਜੀਪੀਐਸ ਆ ਗਿਆ ਹੋਇਆ ਤਾਂ ਹਰ ਕਾਰ ਵਿੱਚ ਹਰ ਫੋਨ 'ਚ ਜੀਪੀਐਸ ਪਹਿਲਾਂ ਹੀ ਲੱਗਿਆ ਹੁੰਦਾ ਜੀਪੀਐਸ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੁਸੀਂ ਕਿਹੜੇ ਰਸਤੇ 'ਤੇ ਜਾਣਾ ਤੁਸੀਂ ਗਲਤ ਤਾਂ ਨਹੀਂ ਜਾ ਰਹੇ ਸੱਜੇ ਮੁੜਨਾ ਕਿ ਖੱਬੇ ਮੁੜਨਾ ਅੱਗੇ ਜਾ ਕੇ ਕਿੱਥੇ ਤੁਹਾਨੂੰ ਰਸਤਾ ਮਿਲੇਗਾ ਅਤੇ ਇਸ ਦੇ ਨਾਲ ਸੰਸ ਸੰਸਾਰ ਦੀ ਪੜਚੋਲ ਕਰਨ ਦੇ ਤਰੀਕੇ ਨੂੰ ਇਹ ਕਿਵੇਂ ਬਦਲ ਰਹੀ ਹੈ ਟੈਕਨੋਲੋਜੀ ਜਿਵੇਂ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜੇ ਤੁਸੀਂ ਕਦੇ ਕੋਈ ਜਗ੍ਹਾ ਨਹੀਂ ਦੇਖੀ ਜਿਵੇਂ ਤੁਹਾਡੇ ਘਰ 'ਚ ਕੋਈ ਬਜ਼ੁਰਗ ਹੈ ਉਹ ਯਾਤਰਾ ਕਰਨਾ ਚਾਹੁੰਦਾ ਤੀਰਥਾਂ 'ਤੇ ਜਾਣਾ ਚਾਹੁੰਦਾ ਪਰ ਹੁਣ ਉਹ ਬਜ਼ੁਰਗ ਹੋ ਚੁੱਕਿਆ ਉਹ ਨਹੀਂ ਜਾ ਸਕਦਾ ਉਹ ਸਫਰ ਨਹੀਂ ਕਰ ਸਕਦਾ ਤਾਂ ਉਹਦੇ ਨਾਲ ਉਹ ਕੀ ਕਰ ਸਕਦਾ ਕਿ ਓਗਮੈਂਟਿਡ ਰਿਐਲਿਟੀ ਹੁੰਦੀ ਹੈ ਕਿ ਤੁਸੀਂ ਵਰਚੁਅਲ ਵਰਲਡ ਵਰਚੁਅਲ ਦੁਨੀਆਂ 'ਚ ਚਲੇ ਜਾਂਦੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਦੁਨੀਆਂ 'ਚ ਹੋ ਪਰ ਅਸਲ ਵਿੱਚ ਤੁਸੀਂ ਉਸ ਦੁਨੀਆਂ 'ਚ ਨਹੀਂ ਹੁੰਦੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਕਿਸੇ ਵੀ ਬਜ਼ੁਰਗ ਨੂੰ ਜਿਵੇਂ ਐਵੇਂ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਸ ਆ ਗਈਆਂ ਹੋਈਆਂ ਕਿ ਤੁਸੀਂ ਕਿਸੇ ਵੀ ਬਜ਼ੁਰਗ ਨੂੰ ਉਸ ਜਗ੍ਹਾ 'ਤੇ ਉਸ ਜਗ੍ਹਾ ਦੀ ਫੀਲ ਦਵਾ ਸਕਦੇ ਹੋ ਜਿਹੜਾ ਉਹ ਜਗ੍ਹਾ ਦੇ ਨਾਲ ਜਿਹੜੇ ਵੀ ਉਹਦੇ ਇਮੋਸ਼ਨ ਜਿਹੜੇ ਉਹਦੀਆਂ ਉਹਦੇ ਕੋਈ ਧਰਮ ਨਾਲ ਉਹ ਜੁੜਿਆ ਹੋਇਆ ਤਾਂ ਉਹਨੂੰ ਉਹ ਬਹੁਤ ਵਧੀਆ ਲੱਗਦਾ ਉਹ ਉਹਦੇ ਨਾਲ ਉਹਨੂੰ ਲੱਗੇਗਾ ਕਿ ਉਹ ਉਸ ਜਗ੍ਹਾ 'ਤੇ ਪਹੁੰਚ ਕੇ ਉਹਨੇ ਉਸ ਜਗ੍ਹਾ 'ਤੇ ਜਾ ਕੇ ਦਰਸ਼ਨ ਕਰ ਲਏ ਤਾਂ ਇਸ ਤਰ੍ਹਾਂ ਸੰਸਾਰ ਦੀ ਪੜਚੋਲ ਕਰਨੀ ਵੀ ਹੁਣ ਬਹੁਤ ਆਸਾਨ ਹੋ ਚੁੱਕੀ ਹੈ ਟੈਕਨੋਲੋਜੀ ਇਸ ਚੀਜ਼ ਨੂੰ ਬਹੁਤ ਬਦਲ ਰਹੀ ਹੈ